ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਕਿੱਥੋਂ ਬੋਲ ਰਹੇ ਹੋ ਤੁਸੀਂ ਹਾਂਜੀ ਮੈਮ ਅਸੀਂ ਨਾ ਟ੍ਰਿਪ ਟ੍ਰਿਪ 'ਤੇ ਜਾਣਾ ਹੈਗਾ ਹਾਂਜੀ ਸਾਨੂੰ ਤੁਸੀਂ ਦੱਸ ਸਕਦੇ ਹੋ ਵੀ ਤਾਂ ਮੈਮ ਸਾਡੇ ਕੋਲ ਹਫ਼ਤੇ ਕੁ ਦਾ ਹੈਗਾ ਟੈਮ ਸਾਡੇ ਕੋਲ ਅਸੀਂ ਪੰਜ ਜਣੇ ਆ ਜੀ ਹਾਂਜੀ ਮੈਮ ਅਸੀਂ ਧਾਰਮਿਕ ਜਗ੍ਹਾ 'ਤੇ ਜਾਣਾ ਗਾ ਜੀ ਹਾਂਜੀ ਆਊਟ ਆਫ ਪੰਜਾਬ ਜਾਣਾ ਮੈਮ ਅਸੀਂ ਇੰਨਾ ਤਾਂ ਫਿਰ ਮੈਮ ਦੇਖ ਕੇ ਪਤਾ ਚੱਲਦਾ ਹੈਗਾ ਹੈ ਨਾ ਕਿੰਨਾ ਕੁ ਖਰਚਾ ਆ ਜਾਂਦਾ ਤਾਂ ਹੀ ਅਸੀਂ ਤੁਹਾਡੇ ਤੋਂ ਲੈ ਰਹੇ ਹਾਂ ਗੇ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਮੈਮ ਅਸੀਂ ਪਲਾਨ ਸਾਡਾ ਇਹ ਹੀ ਹੈਗਾ ਵੀ ਹਜ਼ੂਰ ਸਾਹਿਬ ਵਗੈਰਾ ਜਾਣ ਦਾ ਨਾਲੇ ਬੱਚਿਆਂ ਨੂੰ ਉਥੇ ਸਿੱਖਣ ਨੂੰ ਮਿਲਦਾ ਕੁਛ ਦੇਖਣ ਨੂੰ ਮਿਲਦਾ ਹੈ ਨਾ ਕੁਛ ਬੱਚਿਆਂ ਨੂੰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਘੁਮਾਵਾਂਗੇ ਹੈ ਨਾ ਗੁਰਦੁਆਰੇ ਦੇਖਣ ਯੋਗ ਨੇ ਹਜ਼ੂਰ ਸਾਹਿਬ ਵਿੱਚ ਹਾਂਜੀ ਇਹ ਇਹ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਮੈਮ ਹਾਂਜੀ ਮੈਮ ਫਿਰ ਸਾਡਾ ਤੁਸੀਂ ਨਾ ਇਦਾਂ ਕਰੋ ਪੰਜਾਹ ਹਜ਼ਾਰ ਦਾ ਵੀ ਸਾਨੂੰ ਪੰਜਾਹ ਹਜ਼ਾਰ ਦੇ ਵਿੱਚ ਹੀ ਸਾਡੇ ਸਾਰੇ ਕਮਰੇ ਵਗੈਰਾ ਬੁੱਕ ਕਰਵਾ ਕੇ ਨਾਲ ਆਪਣੇ ਕੋਈ ਜਿਹੜਾ ਹੁਣ ਹੁੰਦਾ ਆਪਣਾ ਬੋਡੀਗਾਰਡ ਵਗੈਰਾ ਹੈਨਾ ਉਹ ਸਾਰੇ ਸਾਨੂੰ ਤੁਸੀਂ ਕਰਨਾ ਹੋਊਗਾ ਹੈਨਾ ਉਹ ਹੁਣ ਮੌਸਮ ਵੀ ਸਹੀ ਹੈ ਹੈ ਨਾ ਹੁਣ ਮੌਸਮ ਵੀ ਸਹੀ ਹੈ ਹਜ਼ੂਰ ਸਾਹਿਬ ਜਾਣ ਨੂੰ ਅਤੇ ਹਾਂਜੀ ਅਸੀਂ ਮੈਮ ਮਾਰਚ ਮਾਰਚ ਮਹੀਨੇ 'ਚ ਜਾਣਾ ਸੀ ਦਸ ਮਾਰਚ ਤੱਕ ਦਸ ਮਾਰਚ ਤੋਂ ਦੇ ਬਾਅਦ ਜਾਣਾ ਜੀ ਅਸੀਂ ਮੈਮ ਫਿਰ ਉਸਤੋਂ ਬਾਅਦ ਉੱਥੇ ਗਰਮੀ ਹੋ ਜਾਂਦੀ ਹੈ ਅਤੇ ਬਾਕੀ ਮੈਮ ਬੱਚਿਆਂ ਨੂੰ ਪੁੱਛਾਂਗੀ ਬੱਚੇ ਤਾਂ ਦਸ ਤਰੀਕ ਤੋਂ ਬਾਅਦ ਵੀ ਕਹਿੰਦੇ ਸੀਗੇ ਹਾਂਜੀ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਮੈਮ ਮੈਂ ਨਾ ਬੱਚਿਆਂ ਨਾਲ ਆਪਣੀ ਰਾਇ ਕਰਕੇ ਤੁਹਾਡੇ ਨਾਲ ਫਿਰ ਹਾਂਜੀ ਠੀਕ ਹੈ ਅਤੇ ਫਿਰ ਤੁਸੀਂ ਮੈਂ ਤੁਹਾਨੂੰ ਫੋਨ ਕਰੂੰਗੀ ਤਾਂ ਫਿਰ ਤੁਸੀਂ ਚੁੱਕ ਲਿਓ ਫੋਨ ਠੀਕ ਮੈਮ ਹਾਂ ਫਿਰ ਕਿੰਨੀ ਕਿੰਨੀ ਦੇਰ ਤੁਸੀਂ ਨਾ ਫੋਨ ਨਹੀਂ ਚੁੱਕਦੇ ਹੈਗੇ ਅਤੇ ਫਿਰ ਮੈਂ ਇਹਨੂੰ ਪਤਾ ਨਹੀਂ ਲੱਗਦਾ ਹੈਗਾ ਫਿਰ ਮੈਂ ਉਸ ਤੋਂ ਬਾਅਦ ਮੈਂ ਬੁੱਕ ਕਰਵਾਊਂਗੀ ਜੀ ਠੀਕ ਹੈ ਮੈਮ ਹਾਂਜੀ ਮਿਹਰਬਾਨੀ ਮੈਮ ਕੋਲ ਸੁਣਨ ਲਈ ਮਿਹਰਬਾਨੀ ਓਕੇ ਓਕੇ ਓਕੇ